ਸਾਡੇ ਕੋਲ ਜਿਵੇਂ ਮੱਝਾਂ ਗਾਂਈਆਂ ਰੱਖੀਆਂ ਮੈ ਨੇ ਜੀ ਮੱਝ ਵੀ ਨੇ ਅਤੇ ਗਾਂਈ ਵੀ ਹੈ ਅਤੇ ਕੱਟਰੂ ਵੀ ਹੁੰਦੇ ਨੇ ਜਿਵੇਂ ਕਿ ਉਹਨਾਂ ਨੂੰ ਸਵੇਰੇ ਸਵੇਰੇ ਚਾਰ ਵਜੇ ਉਹਨਾਂ ਨੂੰ ਕੱਖ ਪਾਉਣੇ ਜੀ ਦੇਖਣਾ ਜਾ ਕੇ ਵੀ ਫਿਰ ਉਹਨੂੰ ਕੱਖ ਪਾਉਣ ਤੋਂ ਬਾਅਦ ਅਸੀਂ ਉਹਨਾਂ ਦਾ ਥੱਲੇ ਸਫਾਈ ਕਰਦੇ ਹਾਂ ਜੀ ਗੋਹਾ ਇਕੱਠਾ ਕੀਤਾ ਜਾਂਦਾ ਹੈ ਇਸ ਕਰਕੇ ਕਿ ਉਹਨਾਂ ਦੀ ਦੇਖਭਾਲ ਚੰਗੀ ਤਰ੍ਹਾਂ ਹੋਵੇ ਫਿਰ ਸਫਾਈ ਕਰਨ ਤੋਂ ਬਾਅਦ ਉਹਦੇ ਫਰਸ਼ ਨੂੰ ਚੰਗੀ ਤਰ੍ਹਾਂ ਅਸੀਂ ਪਾਣੀ ਨਾਲ ਧੋਂਦੇ ਹਾਂ ਕਿਉਂਕਿ ਫਿਰ ਉਹ ਤੋਂ ਬਾਅਦ ਅਸੀਂ ਇਹਨਾਂ ਦੀਆਂ ਧਾਰਾਂ ਵੀ ਚੋਂਨੇ ਆ ਅਤੇ ਧਾਰਾਂ ਚੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਦਾਣਾ ਪਾਉਂਦੇ ਹਾਂ ਕਿ ਦਾਣਾ ਪਾਉਣ ਦੇ ਨਾਲ ਦੁੱਧ ਦੇ ਵਿੱਚ ਦੁੱਧ ਵੀ ਵੱਧ ਜਾਂਦਾ ਹੈ ਅਤੇ ਡੰਗਰ ਦੇ ਮਨ ਨੂੰ ਐਏਂ ਵੀ ਹੋ ਜਾਂਦਾ ਵੀ ਚੱਲ ਹੁਣ ਸਾਨੂੰ ਦਾਣਾ ਪਾਤਿਆ ਇਸ ਕਰਕੇ ਕਿ ਜਿਵੇਂ ਹੁਣ ਮੱਝਾਂ ਹੁੰਦੀਆਂ ਨੇ ਜੀ ਇਹਨਾਂ ਨੂੰ ਇਹ ਮੌਸਮ ਦੇ ਵਿੱਚ ਮੱਖੀ ਹੁੰਦੀ ਹੈ ਜੀ ਇੱਕ ਜਿਵੇਂ ਉਹ ਬਹੁਤ ਤੰਗ ਕਰਦੀ ਹੈ ਉ ਅਸੀਂ ਇਸ ਮੱਖੀ ਨੂੰ ਹਟਾਉਣ ਵਾਸਤੇ ਇੱਕ ਸਪਰੇਅ ਹੁੰਦੀ ਹੈ ਜਿਵੇਂ ਉਹਦੇ ਵਿੱਚ ਫਰਨੈਲ ਰਲਾਈ ਵੀ ਹੁੰਦੀ ਹੈ ਅਤੇ ਕਾਲਾ ਤੇਲ ਅਤੇ ਡੀਜ਼ਲ ਦੀ ਸਪਰੇਅ ਕਰਦੇ ਹਾਂ ਉਹਨਾਂ 'ਤੇ ਇਸ ਕਰਕੇ ਉਹਨਾਂ ਨੂੰ ਮੱਖੀ ਤੋਂ ਰਾਹਤ ਮਿਲ ਜਾਂਦੀ ਹੈ ਜਿਵੇਂ ਗਾਂਈਆਂ ਹੁੰਦੀਆਂ ਨੇ ਜੀ ਇਹਨਾਂ ਨੂੰ ਬਹੁਤ ਇਹਨਾਂ ਦੀ ਸੰਭਾਲ ਰੱਖਣੀ ਪੈਂਦੀ ਹੈ ਜਿਵੇਂ ਕਿ ਇਹਨਾਂ ਦੇ ਪੈਰ ਵੀ ਦੁੱਖਣੇ ਆ ਜਾਂਦੇ ਨੇ ਜੇ ਇਹਨਾਂ ਦੇ ਥੱਲੇ ਸਫਾਈ ਨਾ ਰੱਖੀਏ ਅਤੇ ਇਹਨਾਂ ਨੂੰ ਚਿੱਚੜ ਪੈ ਜਾਂਦੇ ਨੇ ਜੀ ਉਹਦੇ ਕਰਕੇ ਇਹਨਾਂ ਨੂੰ ਦਵਾਈ ਵੀ ਲਾਉਣੀ ਪੈਂਦੀ ਹੈ ਅਤੇ ਇਹਨਾਂ ਨੇ ਜਿਵੇਂ ਹੁਣ ਹਰਾ ਚਾਰਾ ਵੀ ਪਾਉਣਾ ਪੈਂਦਾ ਇਹਨਾਂ ਨੂੰ ਅਸੀਂ ਜਿਵੇਂ ਕੱਟਰੂ ਹੁੰਦੇ ਨੇ ਜੀ ਛੋਟੇ ਉਹ ਜਿਵੇਂ ਉਹਨਾਂ ਨੇ ਦੁੱਧ ਪੀਣ ਦੇ ਨਾਲ ਉਹਨਾਂ ਦੇ ਢਿੱਡ 'ਚ ਕੀੜੇ ਪੈ ਜਾਂਦੇ ਨੇ ਅਸੀਂ ਇਹਨਾਂ ਨੂੰ ਉਹ ਦਿੰਦੇ ਹਾਂ ਜੀ ਦਵਾਈ ਜਿਵੇਂ ਹਫਤੇ ਦਾ ਕੱਟਰੂ ਹੋ ਜਾਂਦਾ ਉਹਨਾਂ ਨੂੰ ਜੂੰਨਾਂ ਦੀ ਗੋਲੀ ਦੇ ਦਿੰਦੇ ਹਾਂ ਕਿਉਂਕਿ ਜਿਵੇਂ ਹੁਣ ਪੱਕੀ ਜਗ੍ਹਾ ਹੁੰਦੀ ਹੈ ਉੱਥੇ ਅਸੀਂ ਇਹਨਾਂ ਦੇ ਥੱਲੇ ਮੈਟ ਵਿਛਾ ਦਿੰਦੇ ਹਾਂ ਜਿਵੇਂ ਕਿ ਇਹਨਾਂ ਦੇ ਜਿਹੜੇ ਗੋਡੇ ਹੁੰਦੇ ਨੇ ਉਹਨਾਂ ਨੂੰ ਰਗੜਾਂ ਨਾ ਲੱਗਣ ਕਿਉਂਕਿ ਜਿਵੇਂ ਹੁਣ ਇਹਨਾਂ ਨੂੰ ਫਿਰ ਸਵੇਰੇ ਨਹਾਉਂਦੇ ਹਾਂ ਨਹਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਿੰਡਾ ਮਲ ਕੇ ਅਤੇ ਫਿਰ ਇਹਨਾਂ ਨੂੰ ਧੁੱਪ ਦੇ ਵਿੱਚ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਖੜਾਉਂਦੇ ਹਾਂ ਕਿ ਸਰੀਰ ਇਹਨਾਂ ਦਾ ਖੁੱਲ੍ਹ ਜਾਵੇ ਕਿ ਜਿਵੇਂ ਹੁਣ ਕੱਚੀ ਜਗ੍ਹਾ 'ਚ ਵੀ ਬੰਨ੍ਹਦੇ ਹਾਂ ਕਿਉਂਕਿ ਇਹਨਾਂ ਦੇ ਪੈਰਾਂ ਨੂੰ ਥੋੜ੍ਹਾ ਜਿਹਾ ਆਰਾਮ ਮਿਲ ਜਾਵੇ ਫਿਰ ਇਸ ਕਰਕੇ ਅਸੀਂ ਇਹਨਾਂ ਨੂੰ ਇ ਇਕਣਾ ਦੇਖਭਾਲ ਕਰੀ ਜਾਂਦੀ ਹੈ ਅਤੇ ਪਾਣੀ ਜਿਹੜਾ ਹੁੰਦਾ ਹੈ ਅਸੀਂ ਇਹਨਾਂ ਨੂੰ ਸਵੇਰੇ ਠੰਡ ਦੇ ਵਿੱਚ ਪਾਣੀ ਤਾਜ਼ਾ ਪਿਲਾਉਂਦੇ ਹਾਂ ਕਿ ਵੀ ਇਹ ਨਾ ਜਿਵੇਂ ਹੁਣ ਠੰਡ ਚੱਲਦੀ ਹੈ ਆ ਜੀ ਪਾਣੀ ਠੰਡਾ ਹੁੰਦਾ ਜ਼ਿਆਦਾ ਇਹਨਾਂ ਦੇ ਦੰਦਾਂ ਨੂੰ ਠਰਕਾ ਲੱਗ ਜਾਂਦਾ ਹੈ ਕਿਉਂਕਿ ਅਸੀਂ ਹੁਣ ਇਹਨਾਂ ਨੂੰ ਤਾਜ਼ਾ ਪਾਣੀ ਪਿਲਾਉਂਦੇ ਹਾਂ ਇਹ ਡੰਗਰਾਂ ਦੀ ਦੇਖਭਾਲ ਸੰਭਾਲ ਹੁੰਦੀ ਜੀ